ਛੇ ਜਨਵਰੀ ਉੱਨੀ ਸੌ ਸੰਤਾਲੀ ਪੰਦਰ੍ਹਾਂ ਅਗਸਤ ਉੱਨੀ ਸੌ ਤ੍ਰਿਆਨਵੇਂ ਨੌਂ ਮਈ ਉੱਨੀ ਸੌ ਉਣਾਨਵੇਂ ਚੌਦ੍ਹਾਂ ਮਾਰਚ ਦੋ ਹਜ਼ਾਰ ਦੋ ਦਸ ਜੁਲਾਈ ਦੋ ਹਜ਼ਾਰ ਬਾਰ੍ਹਾਂ